ਜਦੋਂ ਮੈਂ ਅਠਾਰਾਂ ਸਾਲ ਦਾ ਸੀ ਤਾਂ ਮੈਂ ਆਪਣੀ ਕਾਲਜੀ ਪੜ੍ਹਾਈ ਕਰਨ ਲਈ ਲੁਧਿਆਣੇ ਗਿਆ ਉੱਥੇ ਮੈਨੂੰ ਆਪਣਾ ਖਾਣਾ ਖੁਦ ਬਣਾਉਣਾ ਪੈਂਦਾ ਸੀ ਕਿਉਂਕਿ ਮੈਂ ਉੱਥੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ ਪਹਿਲਾਂ ਪਹਿਲਾਂ ਤਾਂ ਮੈਨੂੰ ਖਾਣਾ ਬਣਾਉਣਾ ਨਹੀਂ ਆਇਆ ਅਤੇ ਮੈਂ ਬਹੁਤ ਹੀ ਨੁਕਸਾਨ ਕੀਤਾ ਅਤੇ ਫੇਰ ਮੈਂ ਜਦੋਂ ਆਪਣੀ ਪਹਿਲੀ ਛੁੱਟੀ 'ਤੇ ਘਰ ਆਇਆ ਤਾਂ ਮੈਂ ਆਪਣੀ ਮਾਤਾ ਜੀ ਤੋਂ ਕੁਝ ਖਾਣਾ ਬਣਾਉਣਾ ਸਿੱਖਿਆ ਜਿਵੇਂ ਕਿ ਮੈਗੀ ਸੈਂਡਵਿੱਚ ਦਾਲ ਚੋਲ਼ ਜਿਸ ਕਰਕੇ ਮੈਂ ਉੱਥੇ ਜਾ ਕੇ ਬਹੁਤ ਹੀ ਸੁਖਾਲਾ ਰਿਹਾ ਅਤੇ ਆਪਣਾ ਖਾਣਾ ਖੁਦ ਬਣਾ ਕੇ ਖਾ ਸਕਿਆ ਅਤੇ ਹੁਣ ਮੈਂ ਬਹੁਤ ਹੀ ਚੰਗਾ ਖਾਣਾ ਬਣਾ ਲੈਂਦਾ ਹਾਂ ਅਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਖੁਆਉਂਦਾ ਹਾਂ ਜੋ ਕਿ ਮੇਰੇ ਖਾਣੇ ਦੀ ਬਹੁਤ ਹੀ ਤਾਰੀਫ ਕਰਦੇ ਹਨ ਅਤੇ ਉਂਗਲ਼ਾਂ ਚੱਟਦੇ ਰਹਿ ਜਾਂਦੇ ਹਨ